ਸਾਡੇ ਦੇਸ਼ ਵਿੱਚ ਅਨੇਕ ਤਿਉਹਾਰ ਮਨਾਏ ਜਾਂਦੇ ਹਨ ਜਿੰਨਾਂ ਉੱਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਵੀ ਬਣਦੇ ਹਨ ਮੇਰਾ ਸਭ ਤੋਂ ਫੇਵਰੇਟ ਤਿਉਹਾਰ ਦਿਵਾਲੀ ਹੈਗੀ ਆ ਉਸ ਉੱਤੇ ਤਰ੍ਹਾਂ ਤਰ੍ਹਾਂ ਦੀ ਮਿਠਾਈਆ ਲੋਕ ਖਾਂਦੇ ਹਨ ਜਿਵੇਂ ਰਸਗੁੱਲੇ ਜਲੇਬੀਆਂ ਗੁਲਾਬ ਜਾਮੁਨ ਐਕਸਟੈਕਰਾ ਇਸ ਤਰ੍ਹਾਂ ਦੇ ਤਿਉਹਾਰਾਂ 'ਤੇ ਬਹੁਤ ਵਧੀਆ ਵਧੀਆ ਪਕਵਾਨ ਬਣਦੇ ਹਨ ਉਹਨਾਂ ਨੂੰ ਖਾਣ ਲਈ ਮੈਂ ਉਹਨਾਂ ਤਿਉਹਾਰਾਂ ਦਾ ਪੂਰੇ ਸਾਲ ਇੰਤਜ਼ਾਰ ਕਰਦਾ ਹਾਂ ਹੌਲੀ 'ਤੇ ਗੁਝੀਆ ਖਾਣ ਦਾ ਮਜ਼ਾ ਹੀ ਕੁਛ ਹੋਰ ਹੈਗਾ ਹੈ ਵਿਸਾਖੀ 'ਤੇ ਜਲੇਬੀਆਂ ਖਾਣ ਦਾ ਮਜ਼ਾ ਤਾਂ ਸੱਤਵੇਂ ਅਸਮਾਨ 'ਤੇ ਲੈ ਜਾਂਦਾ ਹੈ ਧਾਰਮਿਕ ਤਿਉਹਾਰਾਂ ਨਾਲ ਸੰਬੰਧਿਤ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਸਾਰੀਆਂ ਆਪਾਂ ਜਨਮਆਸ਼ਟਮੀ 'ਤੇ ਮੱਖਣ ਦਾ ਪ੍ਰਸ਼ਾਦ ਪ੍ਰਸ਼ਾਦ ਚੱਖਦੇ ਹਨ ਮੱਖਣ ਅਤੇ ਮਿਸ਼ਰੀ ਦਾ ਅਤੇ ਅਲੱਗ ਅਲੱਗ ਧਰਮਾਂ ਦੇ ਅਲੱਗ ਅਲੱਗ ਤਿਉਹਾਰਾਂ 'ਤੇ ਵੀ ਅਲੱਗ ਅਲੱਗ ਪਕਵਾਨ ਬਣਦੇ ਹਨ ਉਹਨਾਂ ਪਕਵਾਨਾਂ ਨੂੰ ਬਹੁਤ ਜੀਅ ਜਾਨ ਨਾਲ ਬਣਾਇਆ ਜਾਂਦਾ ਹੈ